ਭੰਗੜਾ ਆਰੋਬਿਕਸ ਬਹੁਤ ਵਧੀਆ ਹੈਗਾ ਇਹਦੇ ਵਿੱਚ ਡਾਂਸ ਵਗੈਰਾ ਅਸੀਂ ਦੇਖਦੇ ਹਾਂ ਹੋਰ ਬਹੁਤ ਵਧੀਆ ਲੱਗਦਾ ਡਾਂਸ ਦੇ ਵਿੱਚ ਇੰਨੀ ਮਤਲਬ ਊਰਜਾ ਵੀ ਪੈਦਾ ਹੁੰਦੀ ਹੈ ਅਤੇ ਉਤਸ਼ਹ ਵੀ ਮਿਲਦਾ ਆ ਅਤੇ ਆਪਣਾ ਸਿਹਤ ਜਬੋਂ ਵੀ ਬੰਦੇ ਨੂੰ ਠੀਕ ਲੱਗਦਾ ਕਿਉਂਕਿ ਭੰਗੜੇ ਵਿੱਚ ਹਰ ਇੱਕ ਚੀਜ਼ ਦੀ ਵਰਜਿਸ਼ ਹੁੰਦੀ ਆ ਹੁਣ ਤਾਂ ਯੋਗਾ ਵਗੈਰਾ ਲੋਕ ਕਰਦੇ ਹੈਗੇ ਆ ਭੰਗੜੇ ਵਿੱਚ ਨੱਚਣਾ ਕੁੱਦਣਾ ਟੱਪਣਾ ਤੁਰਲੇ ਵਾਲੀਆਂ ਪੱਗਾਂ ਬੰਨ੍ਹਣੀਆਂ ਚਾਦਰੇ ਬੰਨ੍ਹਣੇ ਮਤਲਬ ਬਹੁਤ ਵਧੀਆ ਮਨੋਰੰਜਨ ਜਿਹੜਾ ਹੈਗਾ ਉਹ ਉਹਨਾਂ ਉਹ ਉਹ ਹੋ ਰਿਹਾ ਔਰ ਬਹੁਤ ਵਧੀਆ ਹੈਗਾ ਤਾਂ ਕਿ ਭੰਗੜਾ ਬਹੁਤ ਇੱਦਾਂ ਦੀ ਸਿਹਤ ਜਾਬੀ ਲੋਕਾਂ ਨੂੰ ਦਿੰਦਾ ਲੋਕਾਂ ਨੂੰ ਪੁਰਾਣਾ ਸੱਭਿਆਚਾਰ ਦਿੰਦਾ ਲੋਕਾਂ ਦੇ ਗੀਤ ਸੰਗੀਤ ਨਾਲ ਜੋੜਦਾ ਔਰ ਵਧੀਆ ਮਨੋਰੰਜਨ ਦਾ ਇੱਕ ਸਾਧਨ ਹੈ ਔਰ ਭੰਗੜਾ ਇੱਕ ਬਹੁਤ ਹੀ ਔਰਬਿਕਸ ਆਪਾਂ ਇਹਨੂੰ ਵਧੀਆ ਕਹਿ ਸਕਦੇ ਹਾਂ ਅਤੇ ਤਾਂ ਕਿ ਅੱਜ ਕੱਲ੍ਹ ਦੇ ਬੱਚੇ ਨਹੀਂ ਜਾਣਦੇ ਉਹ ਜਦੋਂ ਆਪਾਂ ਨੂੰ ਭੰਗੜਾ ਦੇਖਦੇ ਆ ਕਰਦੇ ਆ ਉਹ ਦੇਖਦੇ ਆ ਪੁਰਾਣੇ ਜ਼ਮਾਨੇ ਦੇ ਵਿੱਚ ਭੰਗੜਾ ਚੱਲ ਰਿਹਾ ਗਿੱਧਾ ਚੱਲ ਰਿਹਾ ਬੋਲੀਆਂ ਚੱਲ ਰਹੀਆਂ ਇਹ ਹਿਸਾਬ ਨਾਲ ਇਹ ਭੰਗੜਾ ਇੱਕ ਔਰਬਿਕਸ ਦਾ ਵਧੀਆ ਤੌਰ ਤਰੀਕਾ ਵਧੀਆ ਹੈਗਾ ਜੋ